ਗੂਗਲ ਦੁਆਰਾ ਕਾਫ਼ੀ ਆਟੋਮੇਟਿਡ ਟੂਲ ਜਿਹੜੇ ਪ੍ਰੋਵਾਇਡ ਕੀਤੇ ਜਾਂਦੇ ਨੇ ਜਿਵੇਂ ਗੂਗਲ ਮੈਪ ਹੋ ਗਿਆ ਜਾਂ ਜਾਂ ਟਰਾਂਸਲੇਸ਼ਨ ਹੋ ਗਈ ਸ਼ਬਦਾਂ ਦੀ ਪੰਜਾਬੀ ਤੋਂ ਹਿੰਦੀ ਵਿੱਚ ਜਾਂ ਹਿੰਦੀ ਤੋਂ ਅੰਗਰੇਜ਼ੀ 'ਚ ਕਿਸੇ ਵੀ ਬੁਝਾ ਭਾਸ਼ਾ ਤੋਂ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਕਵ ਕਈ ਵਾਰੀ ਇਹ ਹੁੰਦਾ ਹੈ ਕਿ ਗੂਗਲ ਦੁਆਰਾ ਬਿਲਕੁਲ ਸਹੀ ਟਰਾਂਸਲੇਸ਼ਨ ਕੀਤੀ ਜਾਂਦੀ ਹੈ ਅਤੇ ਕਈ ਵਾਰੀ ਇਹ ਹੁੰਦਾ ਕਿ ਕਈ ਵਾਰੀ ਸ਼ਬਦਾਂ ਦਾ ਅਰਥ ਦਾ ਅਨਰਥ ਵੀ ਹੋ ਜਾਂਦਾ ਹੈ ਅਤੇ ਇਵੇਂ ਹੀ ਗੂਗਲ ਮੈਪ ਜਿਹੜਾ ਹੈਗਾ ਜ਼ਿਆਦਾਤਰ ਕੇਸਾਂ ਵਿੱਚ ਬਿਲਕੁਲ ਸਹੀ ਡੈਸਟੀਨੇਸ਼ਨ ਜਾਂ ਸਹੀ ਟਿਕਾਣਿਆਂ ਦੀ ਦੱਸ ਪਾਉਂਦਾ ਹੈ ਔਰ ਕਈ ਵਾਰੀ ਬਹੁਤ ਘੱਟ ਚਾਂਸ ਹੁੰਦੇ ਨੇ ਕਿ ਕਈ ਵਾਰੀ ਗਲਤ ਇਨਫੋਰਮੇਸ਼ਨ ਵੀ ਮੁੱਹਈਆ ਹੋ ਜਾਂਦੀ ਹੈ